ਪਿੰਡਾਂ ਦੇ ਸਕੂਲਾਂ ਅਤੇ ਸ਼ਹਿਰਾਂ ਦੇ ਸਕੂਲਾਂ ਦੇ ਵਿੱਚ ਵਿਭਿੰਨਤਾ ਜਾਂ ਅਸੀਂ ਕਹੀਏ ਪਾੜੇ ਦੇ ਇਹਦੇ 'ਚ ਸਭ ਤੋਂ ਵੱਡੀ ਕਾਰਨ ਹੈ ਜੋ ਅਸੀਂ ਕਹਿ ਸਕਦੇ ਹਾਂ ਵੀ ਲੋਕਾਂ ਦੇ ਜਾਗਰੂਕ ਹੋਣਾ ਜਾਂ ਪਿੰਡਾਂ ਆਂ ਅਤੇ ਸ਼ਹਿਰਾਂ ਦੇ ਵਿੱਚ ਐਜੂਕੇਸ਼ਨ ਸਿਸਟਮ ਦਾ ਅਪ ਡਾਊਨ ਹੋਣਾ ਅਸੀਂ ਸੋਚ ਸਕਦੇ ਹਾਂ ਵੀ ਜੋ ਪਿੰਡਾਂ ਦੇ ਸਕੂਲ ਨੇ ਜਾਂ ਪਿੰਡਾਂ ਦੇ ਕਸਬਿਆਂ ਦੇ ਵਿੱਚ ਜੋ ਲੈ ਲੋਕ ਵਸਦੇ ਨੇ ਉੱਥੋਂ ਦੇ ਲੋਕ ਐਜੂਕੇਟਡ ਨਾ ਹੋਣ ਦਾ ਕਰਕੇ ਜਿਹੜਾ ਉੱਥੋਂ ਦਾ ਵਿਕਾਸ ਆ ਜਿਹੜਾ ਉਹ ਰੁਕ ਜਾਂਦਾ ਮਾਪੇ ਆਪਣੇ ਬੱਚਿਆਂ ਦੇ ਜਿਹੜੇ ਸਕੂਲਾਂ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਨਹੀਂ ਦੇਖ ਪਾਉਂਦੇ ਵੀ ਉਹ ਕਿੱਥੇ ਜੇ ਇ ਸਟੈਂਡ ਕਰਦੇ ਨੇ ਤਾਂ ਅਸੀ ਸੋਚਦੇ ਹਾਂ ਜਦੋਂ ਅ ਐਜੂਕੇਸ਼ਨ ਦੇ ਲੈਵਲ ਦੇ ਵਿੱਚ ਸ਼ਹਿਰਾਂ ਦੇ ਜੋ ਬੱਚੇ ਹੁੰਦੇ ਨੇ ਉਹਨਾਂ ਦੇ ਮਾਪੇ ਵੀ ਜਾਗਰੂਕ ਹੁੰਦੇ ਨੇ ਅਤੇ ਉੱਥੋਂ ਦਾ ਐਜੂਕੇਸ਼ਨ ਸਿਸਟਮ ਵੀ ਵਧੀਆ ਹੁੰਦਾ ਹੈ ਤਾਂ ਉੱਥੇ ਇੱਕ ਇਨਵਾਇਰਮੈਂਟ ਬਣਦਾ ਹੈ ਪੜ੍ਹਾਈ ਦਾ ਤਾਂ ਇੰਨਵਾਇਰਮੈਂਟ ਬਣਾਉਣ ਦੇ ਲਈ ਇੱਕ ਸਿਸਟਮ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਸਾਰੇ ਬੱਚੇ ਪੜ੍ਹਨ ਲਿਖਣ ਵਾਲੇ ਹਨ ਤਾਂ ਉਹ ਬਹੁਤ ਵਧੀਆ ਸੰਸੀਅਰ ਹਨ ਅਤੇ ਸੋਚਦੇ ਹਨ ਵੀ ਅਸੀਂ ਕੁਝ ਬਣਨਾ ਹੈ ਅਸੀਂ ਇੱਕ ਨਾਮ ਖੱਟਣਾ ਹੈ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਤਾਂ ਉਹੀ ਬੱਚੇ ਕਾਮਯਾਬ ਹੋ ਸਕਦੇ ਨੇ ਤਾਂ ਸਭ ਤੋਂ ਵੱਡਾ ਪੰਜਾਬ ਦੇ ਅ ਵਿੱਚ ਜੇ ਦੇਖਿਆ ਜਾਵੇ ਤਾਂ ਪਿੰਡਾਂ ਦੇ ਸ਼ਹਿਰਾਂ ਦੇ ਸਕੂਲਾਂ ਦੇ ਵਿੱਚ ਸਭ ਤੋਂ ਵੱਡਾ ਪਾੜੇ ਦਾ ਕਾਰਨ ਕਹਿ ਸਕਦੇ ਹਾਂ ਬਈ ਅੰਨਡਿਵੈਲਪਮੈਂਟ ਅਤੇ ਐਜੂਕੇਸ਼ਨ ਦੀ ਕਮੀ ਜਾਂ ਅਸੀਂ ਕਹਿ ਸਕਦੇ ਹਾਂ ਅ ਲੋਕ ਜਾਗਰੂਕ ਨਹੀਂ ਹਨ ਮਾਪੇ ਅਨਪੜ੍ਹ ਹਨ ਸੋ ਇਹ ਸਭ ਤੋਂ ਵੱਡਾ ਕਾਰਨ ਹੈ ਕਿ ਸ਼ਹਿਰਾਂ ਦੇ ਸਕੂਲ ਅਤੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਕਾਫ਼ੀ ਵਿਭਿੰਨਤਾ ਹੈ ਤਾਂ ਕਰਕੇ ਹੀ ਸ਼ਹਿਰਾਂ ਦੇ ਸਕੂਲ ਤਰੱਕੀ ਦੇ ਵੱਲ ਹਨ ਪਰ ਉਹ ਵੱਧ ਐਜੂਕੇਸ਼ਨ ਦੇ ਕਾਰਨ ਜਿਹੜੀ ਹੈ ਪਿੰਡਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਉਹ ਵੀ ਤਰੱਕੀ ਦੇ ਰਾਹਾਂ ਦੇ ਚੱਲ ਪਏ ਨੇ